ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਗੱਡੀ ਬੁਕਿੰਗ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਵੀਰ ਜੀ ਮੈਂ ਤੁਹਾਡਾ ਨੰਬਰ ਨਾ ਔਨਲਾਇਨ ਲਿਆ ਮੈਂ ਤੁਹਾਡੀਆਂ ਕਾਫ਼ੀ ਐਡਜ਼ ਵੀ ਦੇਖ ਰਹੀ ਸੀ ਤਾਂ ਮੈਂ ਇੱਕ ਗੱਡੀ ਬੁੱਕ ਕਰਨੀ ਹੈ ਅੰਮ੍ਰਿਤਸਰ ਟੂਰ ਲਈ ਅਸਲ 'ਚ ਜੂਨ ਦੀਆਂ ਛੁੱਟੀਆਂ ਹੋਗੀਆਂ ਹਾਂਜੀ ਹਾਂ ਮੈਂ ਛੋਟੀ ਗੱਡੀ ਕਰਨੀ ਹੈ ਬੁੱਕ ਮੇਰੇ ਪਰਿਵਾਰ ਦੇ ਕੁੱਲ ਚਾਰ ਮੈਂਬਰ ਜਾਣਗੇ ਤਾਂ ਮੈਨੂੰ ਉਸ ਹਿਸਾਬ ਨਾਲ ਛੋਟੀ ਗੱਡੀ ਦਾ ਦੱਸੋ ਵੀ ਉਹਦਾ ਕਿੰਨਾ ਕਿਰਾਇਆ ਲਓਗੇ ਤੁਸੀਂ ਅੱਛਾ ਹਾਂਜੀ ਏ ਸੀ ਵਾਲੀ ਕਰਨੀ ਹਾਂਜੀ ਏ ਸੀ ਵਾਲੀ ਹਾਂਜੀ ਛੋਟੀ ਦਾ ਹਾਂਜੀ ਸੱਤ ਹਜ਼ਾਰ ਓਕੇ ਠੀਕ ਹੈ ਜੀ ਸੱਤ ਹਜ਼ਾਰ ਅਤੇ ਟੋਲ ਪਲਾਜ਼ਾ ਵੀਰ ਜੀ ਵਿੱਚ ਹੋਊਗਾ ਨਾ ਠੀਕ ਹੈ ਅਤੇ ਫਿਰ ਹਾਂਜੀ ਫੈਮਿ ਕੁਛ ਸਮਾਨ ਵੀ ਜ਼ਿਆਦਾ ਹੋਜੂਗਾ ਅਗਰ ਵੱਡੀ ਤੁਸੀਂ ਦੱਸੋ ਵੀ ਮੈਂ ਵੱਡੀ ਗੱਡੀ ਕਰਾਂ ਕਿ ਛੋਟੀ ਵੱਡੀ ਫਿਰ ਵੱਡੀ ਦਾ ਕਿੰਨਾ ਰੇਟ ਹੋਊਗਾ ਦਸ ਹਜ਼ਾਰ ਠੀਕ ਹੈ ਜੀ ਅਤੇ ਹੋਰ ਕੋਈ ਸਹੂਲਤ ਕੋਈ ਹੋਰ ਖਾਣ ਪੀਣ ਦਾ ਜਿਵੇਂ ਰਸਤੇ ਦੇ ਵਿੱਚ ਅੱਛਾ ਹੋਰ ਕੋਈ ਸਹੂਲਤ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਚਲੋ ਕੋਈ ਨਹੀਂ ਵੀਰ ਜੀ ਮੈਂ ਤੁਹਾਨੂੰ ਰਾਏ ਕਰਕੇ ਦੱਸਦੀ ਹਾਂ ਫਿਰ ਤਾਂ ਤੁਹਾਡੀ ਸਾਡੀ ਇੱਕ ਬੁਕਿੰਗ ਕਰ ਦੇਣਾ ਹਾਂਜੀ ਹਾਂਜੀ ਠੀਕ ਹੈ ਓਕੇ